ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਸਰ ਤੁਸੀਂ ਪਹਿਲਾਂ ਕਿਤੋਂ ਦਵਾਈ ਲੈਂਦੇ ਹਾਂ ਜੀ ਅੱਛਾ ਜੀ ਕਿੱਥੋਂ ਚੱਲਦੀ ਤੁਹਾਡੀ ਦਵਾਈ ਦਵਾਈ ਕਿੱਥੋਂ ਚੱਲਦੀ ਤੁਹਾਡੀ ਅੱਛਾ ਜੀ ਹਾ ਹਾਂਜੀ ਹਾਂਜੀ ਸਰ ਐਂ ਇੱਦਾਂ ਕਰਿਓ ਜੀ ਤੁਸੀਂ ਨਾ ਸੋਮਵਾਰ ਨੂੰ ਹਾਂਜੀ ਤੁਸੀਂ ਐਂ ਕਰਿਓ ਜੀ ਤੁਸੀਂ ਸੋਮਵਾਰ ਨੂੰ ਆਪਣਾ ਮੈਕਸ ਹੋਸਪਿਟਲ ਆ ਜਿਓ ਜੀ ਅਤੇ ਉੱਥੇ ਤੁਹਾਡੇ ਟਾਇਮ ਸਰ ਤੁਸੀਂ ਗਿਆਰ੍ਹਾਂ ਕੁ ਵਜੇ ਆ ਜਿਓ ਹਾਂ ਅਤੇ ਉੱਥੇ ਤੁਹਾਡੀ ਡਾਕਟਰ ਸਾਹਿਬ ਨਾਲ ਅਸੀਂ ਅਪੁਆਇੰਟਮੈਂਟ ਫਿਕਸ ਕਰਾ ਦਾਂਗੇ ਤੁਹਾਡੇ ਉਹ ਟੈਸਟ ਲਿਖਣ ਕੇ ਦੇਣਗੇ ਫਿਰ ਉਹ ਟੈਸਟ ਕਰਵਾ ਲਿਓ ਨਹੀਂ ਟੈਸਟ ਟੈਸਟ ਹੋਊਂਗੇ ਜੀ ਟੈਸਟ ਫਿਰ ਉਹ ਹਿਸਾਬ ਨਾਲ ਲਿਖੂਗੇ ਨਾ ਦਵਾਈ ਤੁਹਾਨੂੰ ਹਾਂਜੀ ਇਹ ਸਰ ਤੁਹਾਡੇ ਸਾਰੇ ਟੈ ਹਾਂਜੀ ਉਹ ਤੁਹਾਨੂੰ ਸਾਰੇ ਟੈਸਟ ਹੋਊਂਗੇ ਡਾਕਟਰ ਸਾਹਿਬ ਤੁਹਾਨੂੰ ਦੱਸੂਗੇ ਅਗਰ ਦਵਾਈ ਹਾਂਜੀ ਅਗਰ ਤਾਂ ਦਵਾਈ ਤੁਹਾਡੀ ਚੱਲਣੀ ਹੋਈ ਤਾਂ ਦਵਾਈ ਨਾਲ ਚਲਾ ਦਾਂਗੇ ਨਹੀਂ ਫਿਰ ਤੁਹਾਡਾ ਓਪਰੇਸ਼ਨ ਕਰਵਾਵਾਂਗੇ ਨਹੀਂ ਆਪਣੇ ਕੋਲ ਬੜੇ ਐਕਸਪਰਟ ਡਾਕਟਰ ਹੈ ਜੀ ਆਪਣੇ ਕੋਲ਼ ਪੀ ਜੀ ਆਈ ਦੇ ਐਕਸ ਡਾਕਟਰ ਆਉਂਦੇ ਆ ਜੀ ਉਰੇ ਕੋਈ ਚੱਕਰ ਨਹੀਂ ਟੈਨਸ਼ਨ ਵਾਲੀ ਗੱਲ ਨਹੀਂ ਜੀ